ਪੰਜਾਬ ਵਿੱਚ ਸੰਗੀਤ ਬਹੁਤ ਹੀ ਪ੍ਰਚਲਿਤ ਹੈ ਜਿਸ ਵਿੱਚ ਕਿ ਬੋਲੀਆਂ ਜਿਸ ਵਿੱਚ ਕਿ ਬੋਲੀਆਂ ਟੱਪੇ ਘੋੜੀਆਂ ਸੁਹਾਗ ਆਦਿ ਹਨ ਘੋੜੀਆਂ ਮੁੰਡੇ ਦੇ ਵਿਆਹ ਤੋਂ ਪਹਿਲਾਂ ਗਾਈਆਂ ਜਾਂਦੀਆਂ ਹਨ ਅਤੇ ਸੁਹਾਗ ਕੁੜੀ ਦੇ ਵਿਆਹ ਤੋਂ ਪਹਿਲਾਂ ਗਾਏ ਜਾਂਦੇ ਹਨ ਇਹ ਬਹੁਤ ਸਾਰੇ ਸੰਗੀਤ ਹਨ ਜਿਸ ਵਿੱਚ ਅਤੇ ਬਹੁਤ ਸਾਰੇ ਟੱਪੇ ਹਨ ਜਿਸ ਵਿੱਚ ਕਿ ਇੱਕ ਟੱਪਾ ਇਹ ਵੀ ਹੈ ਕਿ ਮਾਹੀ ਸਾਈਕਲ ਚਲਾਉਂਦਾ ਏ ਉਹ ਤੇਰੀ ਕੀ ਲੱਗਦੀ ਜਿਹਨੂੰ ਪਿੱਛੇ ਬੈਠਾਉਂਦਾ ਹੈ ਅਤੇ ਇਸ ਤੋਂ ਨ੍ਰਿੱਤ ਤਿਉਹਾਰ ਹਨ ਜਿਸ ਵਿੱਚ ਕਿ ਨ੍ਰਿੱਤ ਭੰਗੜਾ ਗਿੱਧਾ ਆਦਿ ਹਨ ਜਿਸ ਨੂੰ ਜਿਸ ਨਾਲ ਕਿ ਕੁੜੀਆਂ ਆਪਣਾ ਮਨੋਰੰਜਨ ਕਰਦੀਆਂ ਹਨ ਅਤੇ ਇਸ ਨਾਲ ਇਸ ਦੇ ਨਾਲ ਨਾਲ ਹੀ ਜੋ ਕਿ ਔਨਲਾਈਨ ਯੂਟਿਊਬ ਜਾਂ ਟੀ ਵੀ 'ਤੇ ਮਸ਼ਹੂਰ ਸਿੰਗਰ ਹਨ ਉਨ੍ਹਾਂ ਦੀ ਸੰਗੀਤਕਾਰੀ ਵੀ ਬਹੁਤ ਹੀ ਮਸ਼ਹੂਰ ਹੈ ਪ੍ਰਸਿੱਧ ਹੈ ਜਿਸਨੂੰ ਕਿ ਹਰ ਕੋਈ ਬੱਚਾ ਬਜ਼ੁਰਗ ਆਦਿ ਜਵਾਨੀ ਵਾਲ਼ੇ ਸਾਰੇ ਹੀ ਸੁਣਦੇ ਹਨ